ਪਿੰਡਾਂ ਦੇ ਵਿੱਚ ਲੋਕ ਜ਼ਿਆਦਾਤਰ ਕਬੱਡੀਆਂ ਘੋ ਘੋਲਾਂ ਨੂੰ ਪਸੰਦ ਕਰਦੇ ਹਨ ਕਿਉਂ ਆਪਾਂ ਮੁੱਢ ਤੌਰ ਤੋਂ ਜੁੜੇ ਆਏ ਆਂ ਆਪਾਂ ਜ਼ੋਰ ਵਾਲੀਆਂ ਗੇਮਾਂ ਨੂੰ ਪਿੰਡਾਂ ਵਾਲੇ ਲੋਕ ਜ਼ਿਆਦਾ ਪਸੰਦ ਕਰ ਰਹੇ ਹਨ ਅਤੇ ਦੂਜੀ ਗੱਲ ਇਹ ਹੋ ਗਈ ਪਿੰਡਾਂ ਦੇ ਵਿੱਚ ਗਰੋਂਡ ਘੱਟੋ ਹੁੰਦੇ ਹਨ ਅਤੇ ਜਿਹੜੇ ਸ਼ਹਿਰ ਹੈ ਸ਼ਹਿਰਾਂ ਦੇ ਵਿੱਚ ਕ ਮਿਊਨਸੀਪਲ ਕਮੇਟੀਆਂ ਬਣੀਆਂ ਹੋਈਆਂ ਨੇ ਉਹ ਚੀਜ਼ਾਂ ਨੂੰ ਪ੍ਰਮੋਟ ਕਰਦੀਆਂ ਹਨ ਹੁਣ ਪਿੰਡਾਂ ਵਿੱਚ ਐਡੀਆਂ ਕੋਈ ਗਰਾਂਟਾਂ ਬੜੀਆਂ ਆਉਂਦੀਆਂ ਨਹੀਂ ਵੀ ਵਧੀਆ ਗਰਾਊਂਡ ਬਣਾ ਦਈਏ ਤਾਂ ਜਿਹੜੀ ਕਬੱਡੀ ਹੋਈ ਘੋਲ ਹੋਈ ਜਾਂ ਜੰਜੀਰਾਂ ਹੋਈਆਂ ਲੱਲੇ ਹੋਏ ਇਹ ਥੋੜ੍ਹੀ ਜਗ੍ਹਾ ਵਿੱਚ ਖੇਡੇ ਜਾ ਸਕਦੇ ਹਨ ਜਿਵੇਂ ਹੁਣ ਦੂਜੀਆ ਗੇਮਾਂ ਹੋ ਗਈਆਂ ਕ੍ਰਿਕਟ ਹੋ ਗਈ ਫੁਟਬੋਲ ਹੋਈ ਹੋਰ ਬੜ ਵਧੀਆ ਗੇਮਾਂ ਹੋ ਗਈਆਂ ਹੋਕੀ ਹੋ ਗਈ ਇਹ ਗਰਾਊਂਡਾਂ ਵਿੱਚ ਹੀ ਖੇਡੀਆਂ ਜਾ ਸਕਦੀਆਂ ਨੇ ਹੁਣ ਜਿਹੜੇ ਗਰਾਊਂਡ ਬਣੇ ਹੋਏ ਨੇ ਉਹ ਸ਼ਹਿਰਾਂ ਦੇ ਵਿੱਚ ਹੀ ਬਣੇ ਹੋਏ ਨੇ ਗਰਾਊਂਡ ਪਿੰਡਾਂ ਦੇ ਵਿੱਚ ਐਡਾ ਕੋਈ ਵਧੀਆ ਬਣਿਆ ਨਹੀਂ ਹੋਇਆ ਇਸ ਲਈ ਨਾ ਪਿੰਡਾਂ ਆਲੇ ਲੋਕ ਘੋਲਾਂ ਕਬੱਡੀਆਂ ਨੂੰ ਪਸੰਦ ਕਰਦੇ ਹਨ ਅਤੇ ਸ਼ਹਿਰੀ ਲੋਕ ਕ੍ਰਿਕਟ ਨੂੰ ਹੋਕੀ ਨੂੰ ਇੱਦਾਂ ਦੀਆਂ ਗੇਮਾਂ ਨੂੰ ਖੇਲਣਾ ਵੀ ਪਸੰਦ ਕਰਦੇ ਹਨ ਅਤੇ ਦੇਖਣਾ ਵੀ ਪਸੰਦ ਕਰਦੇ ਹਨ